ਹਾਂਜੀ ਇੱਕ ਵਾਰੀ ਮੈਂ ਨਾ ਬਣਾਏ ਗੁਜੀਆ ਬਣਾਏ ਅਤੇ ਬੜੇ ਔਖੇ ਪਹਿਲਾਂ ਤਾਂ ਮੈਨੂੰ ਆਉਂਦੇ ਹੈ ਨਹੀਂ ਸੀ ਮੈਂ ਬੜੇ ਔਖੇ ਉਹ ਘਰੇ ਕਿਸੇ ਤੋਂ ਸਿੱਖੇ ਸੀ ਅਤੇ ਬਣਾਉਣੇ ਸ਼ੁਰੂ ਕਰੇ ਤਾਂ ਬੜੀਆਂ ਵਿੱਚ ਦਿੱਕਤਾਂ ਆਈਆਂ ਮੈਨੂੰ ਅਤੇ ਬੜੇ ਮੁਸ਼ਕਿਲ ਨਾਲ ਮੈਂ ਉਹ ਕਰਿਆ ਉਨ੍ਹਾਂ ਨੂੰ ਸੰਭਾਲਿਆ ਬੜੀ ਮੁਸ਼ਕਿਲ ਨਾਲ ਠੀਕ ਕਰਦੀ ਰਹੀ ਅਤੇ ਅੰਤ ਲਾਸਟ ਵਿੱਚ ਆ ਕੇ ਉਹ ਨਾ ਬਣੇ ਵੈਸੇ ਟੇਸਟੀ ਬਣ ਗਏ ਪਰ ਔਖੇ ਬੜੇ ਬਣਾਏ ਮੈਂ ਪਹਿਲੀ ਵਾਰ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਦੁਬਾਰਾ ਫੇਰ ਬਣਾਏ ਤਾਂ ਉਸ ਵਾਰੀ ਫਿਰ ਠੀਕ ਬਣ ਗਏ ਉਸ ਤੋਂ ਬਾਅਦ ਫਿਰ ਮੈਂ ਹੁਣ ਤਾਂ ਬਹੁਤ ਵਧੀਆ ਬਣਾ ਲੈਂਦੀ ਹਾਂ ਪਰ ਪਹਿਲੀ ਵਾਰੀ ਬੜਾ ਔਖਾ ਕੰਮ ਲੱਗਿਆ ਮੈਨੂੰ ਬਹੁਤ ਜ਼ਿਆਦਾ ਔਖੇ ਬਣੇ